ਭੰਗੜਾ ਪੰਜਾਬ ਦਾ ਇੱਕ ਖ਼ਾਸ ਨਾਚ ਹੈ ਇਸ ਵਿੱਚ ਪੰਜਾਬੀ ਗੱਭਰੂ ਨੌਜਵਾਨ ਬਹੁਤ ਜ਼ਿਆਦਾ ਇੰਜੋਏ ਕਰਦੇ ਹਨ ਅਤੇ ਉਹਨਾਂ ਦਾ ਪਹਿਰਾਵਾ ਵੀ ਇੱਕ ਬਹੁਤ ਦਿਲ ਪ੍ਰਚਾਵਾਂ ਹੁੰਦਾ ਹੈ ਅਤੇ ਉਸ ਵਿੱਚ ਉਹ ਕੀ ਕਰਦੇ ਹੈ ਜਿਵੇਂ ਕਿ ਪੱਗ ਬੰਨ੍ਹਦੇ ਹਨ ਅਤੇ ਉਹਨਾਂ ਦਾ ਖ਼ਾਸ ਇੱਕ ਗਹਿਣਾ ਗਹਿਣਾ ਵੀ ਹੁੰਦਾ ਹੈ ਅਤੇ ਭੰਗੜਾ ਸਮੇਂ ਦੇ ਨਾਲ ਨਾਲ ਸਾਡੇ ਪੰਜਾਬ ਦਾ ਇੱਕ ਖ਼ਾਸ ਤਿਉਹਾਰ ਵਾਂਗੂੰ ਹੀ ਬਣ ਗਿਆ ਹੈ ਕਿਉਂਕਿ ਇਸ ਵਿੱਚ ਪੰਜਾਬੀ ਗੱਭਰੂ ਅਤੇ ਕੁੜੀਆਂ ਮੁਟਿਆਰਾਂ ਰਲ ਕੇ ਗਿੱਧਾ ਉਹ ਵੀ ਬਣਦੀਆਂ ਅਤੇ ਭੰਗੜਾ ਵੀ ਕਰਦੇ ਹਨ ਅਤੇ ਇਹ ਸਾਨੂੰ ਵੇਖਣ ਵਿੱਚ ਵੀ ਬਹੁਤ ਚੰਗਾ ਲੱਗਦਾ ਹੈ ਇਸ ਵਿੱਚ ਐਨਰਜੀ ਵੀ ਆਉਂਦੀ ਹੈ ਇਸ ਦੇ ਨਾਲ ਨਾਲ ਇਹ ਸਾਡੇ ਲਈ ਇੱਕ ਪ੍ਰਮੁੱਖ ਅਤੇ ਮਹੱਤਵਪੂਰਨ ਪੰਜਾਬ ਦੇ ਲਈ ਬਹੁਤ ਹੀ ਵਧੀਆ ਬਣ ਗਿਆ ਹੈ ਇਸ ਲਈ ਇਸ ਨੂੰ ਇੱਕ ਤਿਉਹਾਰ ਵਾਂਗੂੰ ਵੀ ਮਨਾਇਆ ਜਾਂਦਾ ਹੈ ਇਹ ਇੱਕ ਬਹੁਤ ਹੀ ਦਿਲ ਪਰਚਾਵਾਂ ਹੁੰਦਾ ਹੈ ਇਸ ਵਿੱਚ ਪੰਜਾਬੀ ਨੌਜਵਾਨ ਬਹੁਤ ਇੰਜੋਏ ਕਰਦੇ ਹਨ ਅਤੇ ਉਹ ਬਹੁਤ ਹੀ ਵਧੀਆ ਢੰਗ ਨਾਲ ਇਹਨੂੰ ਪੇਸ਼ ਕਰਦੇ ਹਨ ਅਤੇ ਵੇਖਣ ਵਿੱਚ ਵੀ ਇਹ ਸਾਨੂੰ ਬਹੁਤ ਵਧੀਆ ਲੱਗਦਾ ਹੈ ਇਸ ਲਈ ਇਸ ਨੂੰ ਇੱਕ ਤਿਉਹਾਰ ਵਾਂਗੂੰ ਹੀ ਮਨਾਇਆ ਜਾਣ ਲੱਗ ਪਿਆ ਹੈ